ਹਾਂਜੀ ਮੈਮ ਮੈਮ ਮੈਂ ਤੁਹਾਡਾ ਨੰਬਰ ਆਨਲਾਈਨ ਪਲੇਟਫਾਰਮ ਤੋਂ ਲਿੱਤਾ ਸੀ ਤੇ ਮੈਮ ਮੈਂ ਪੰਜਾਬ ਵਿੱਚ ਆਇਆ ਸੀ ਤੇ ਮੈਂ ਪੰਜਾਬ ਦੇ ਸੱਭਿਆਚਾਰ ਬਾਰੇ ਜਾਣਨਾ ਚਾਹੁੰਦਾ ਸੀਗਾ

ਕਿਵੇਂ ਹੁੰ ਹੁੰ ਠੀਕ ਹੈ ਮੈਮ ਤੁਹਾਡੀ ਇਹ ਸਰਵਿਸ ਦਾ ਪ੍ਰਾਈਜ ਕੀ ਹੁੰਦਾ ਜੀ ਇਹਨਾ ਦੀ ਲੋਕੇਸ਼ਨ ਬਾਰੇ ਓਕੇ ਮੈਮ ਠੀਕ ਹੈ ਮੈਮ ਨਹੀਂ ਮੈਮ ਹੋਰ ਕੁਝ ਨੀ ਨਹੀਂ ਮੈਮ ਓਕੇ ਓਕੇ ਤੁਸੀਂ ਮੈਨੂੰ ਆਪਣਾ ਐਡਰੈਸ ਈਮੇਲ ਕਰ ਦਿਓ

ਹਾਂਜੀ